ਦਸ ਸੱਤ ਸੌ ਪੈਂਹਠ ਗਿਆਰਾਂ ਹਜ਼ਾਰ ਚਾਰ ਸੌ ਅਠੱਤਰ ਸਤਾਰਾਂ ਹਜ਼ਾਰ ਅੱਠ ਸੌ ਨੱਬੇ ਇੱਕ ਲੱਖ ਪੈਂਤੀ ਹਜ਼ਾਰ ਅੱਠ ਸੌ ਅਠੱਨਵੇ